ਹਾਂਜੀ ਸਤਿ ਸ਼੍ਰੀ ਅਕਾਲ ਜੀ ਜੇਕਰ ਆਪਾਂ ਕਰੀਏ ਅੱਜ ਡਾਟਾ ਪਲੈਨ ਦੀ ਤਾਂ ਸਾਡੇ ਹਰ ਇੱਕ ਪਰਿਵਾਰ ਵਿੱਚ ਹਰ ਇੱਕ ਡਾਟਾ ਦਾ ਯੂਸ ਕਰਦਾ ਹੈ ਜੇ ਅਤੇ ਅਸੀਂ ਜ਼ਿਆਦਾਤਰ ਆਈਡੀਆ ਯੂਸ ਕਰਦੇ ਹਾਂ ਕਿਉਂਕੀ ਇਸਦੇ ਵਿੱਚ ਬਹੁਤ ਹੀ ਜ਼ਿਆਦਾ ਸਕੀਮਾਂ ਦਿੰਦੇ ਹਨ ਅਤੇ ਅਸੀਂ ਸਾਡੇ ਹਰ ਪਰਿਵਾਰ ਦੇ ਮੈਂਬਰ ਨੇ ਸਾਢੇ ਪੰਜ ਸੌ ਵਾਲਾ ਨੈੱਟ ਪੈਕ ਪਾਇਆ ਹੈ ਕਿਉਂਕੀ ਉਹਨਾਂ ਦੇ ਵਿੱਚ ਇਹ ਜਿਹੜਾ ਨੈੱਟ ਜਿਹੜਾ ਨੈੱਟ ਬਚ ਜਾਂਦਾ ਇਹ ਵਾਰ ਅਤੇ ਐਤਵਾਰ ਨੂੰ ਦਿੰਦੇ ਹਨ